ਹਾਂਜੀ ਮੇਰਾ ਪਸੰਦੀਦਾ ਜਿਹੜਾ ਮਾਰਸ਼ਲ ਆਰਟ ਹੈ ਨਾ ਉਹ ਹੈਗਾ ਕਰਾਟੇ ਕਿਉਂ ਹੈ ਕਿਉਂਕਿ ਜਿਹੜਾ ਕਰਾਟੇ ਹੈਗਾ ਨਾ ਇੱਕ ਜਪਾਨੀ ਮਾਰਸ਼ ਆਰਟ ਹੈਗਾ ਇਹ ਜਿਹੜਾ ਕਿ ਸਾਨੂੰ ਆਪਣੀ ਸਵੈ ਰੱਖਿਆ ਅਤੇ ਸਰੀਰਕ ਅਤੇ ਮਾਨਸਿਕ ਸਿਖਲਾਈ ਜਿਹੜੀ ਸਾਨੂੰ ਵੀ ਦਿੰਦਾ ਹੈਗਾ ਠੀਕ ਹੈ ਇਸ ਵਿੱਚ ਦੇ ਵਿੱਚ ਕਿ ਅਸੀਂ ਕੀ ਕਰਦੇ ਹਾਂ ਹੱਥਾਂ ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਦੇ ਨਾਲ ਵਾਰ ਕਰਨ ਦੀਆਂ ਤਕਨੀਕਾਂ ਸਿੱਖਦੇ ਹਾਂ ਕਰਾਟੇ ਦੀਆਂ ਜਿਹੜੀਆਂ ਕਈ ਵੱਖ ਵੱਖ ਤਰ੍ਹਾਂ ਦੀਆਂ ਸ਼ੈਲੀਆਂ ਹਨ ਜਿਵੇਂ ਕਿ ਕਿਉਂਕਿ ਸ਼ਿਕਾਈ ਗੋਜੂਰਿਊ ਛੋਟੋਕਾਨ ਠੀਕ ਹੈ ਅਤੇ ਜਿਹੜਾ ਕੀ ਆ ਬਰੂਸ ਲੀ ਹੈਗਾ ਨਾ ਜਿਹੜਾ ਬਰੂਸ ਲੀ ਨੂੰ ਸ਼ਾਇਦ ਸਭ ਤੋਂ ਮਸ਼ਹੂਰ ਕਰਾਟੇ ਅਭਿਆਸੀ ਜਿਹੜਾ ਮੰਨਿਆ ਜਾਂਦਾ ਹੈਗਾ ਅਤੇ ਮੈਂ ਵੀ ਇਸੇ ਨੂੰ ਹੀ ਮੰਨਦਾ ਹੈਗਾ ਕਿਉਂਕਿ ਉਹਨੇ ਆਪਣੀਆਂ ਫਿਲਮਾਂ ਦੇ ਵਿੱਚ ਟੀਵੀ ਸ਼ੋ ਦੇ ਵੀ ਕਰਕੇ ਵੀ ਉਹ ਜਾਣਿਆ ਜਾਂਦਾ ਹੈਗਾ ਉਹਨਾਂ ਨੇ ਜਿਹੜਾ ਕੀ ਹੈ ਮਾਰਸ਼ਲ ਆਰਟ ਨੂੰ ਮੁੱਖ ਧਾਰਾ ਦੇ ਵਿੱਚ ਲਿਆਂਦਾ ਸੀਗਾ ਅਤੇ ਇਹੀ ਮੇਰੇ ਪਸੰਦੀਦਾ ਦਾ ਮਾਰਸ਼ਲ ਆਰਟ ਆਰਟਸ ਨੇ ਹੈਗੇ ਬਰੂਸ ਲੀ ਠੀਕ ਹੈ ਜੀ ਧੰਨਵਾਦ ਜੀ